ਹੈਲੋ ਹੈਲੋ ਹੈਲੋ ਮੈਮ ਤੁਸੀਂ ਆਰਤੀ ਸ਼ਰਮਾ ਬੋਲ ਰਹੇ ਮੈਮ ਮੈਨੂੰ ਨਾ ਮੇਰੇ ਫਰੈਂਡ ਕਮਲ ਨੇ ਨਾ ਤੁਹਾਡਾ ਨੰਬਰ ਦਿੱਤਾ ਸੀਗਾ ਮੈਂ ਉਰੇ ਦੇ ਨਾ ਮੀਨਜ਼ ਕਿ ਟਰਾਂਸਪੋਰਟ ਸਿਸਟਮ ਬਾਰੇ ਪੁੱਛਣਾ ਸੀਗਾ ਤੁਹਾਨੂੰ ਮੀਨਜ਼ ਕਿ ਉਰੇ ਦਾ ਟ੍ਰਾਂਸਪੋਟ ਸਿਸਟਮ ਕਿੱਦਾਂ ਦਾ ਏ ਮੀਨਜ਼ ਕਿ ਵਧੀਆ ਏ ਅਤੇ ਕਿੱਦਾਂ ਦਾ ਕਿਸ ਤਰ੍ਹਾਂ ਦਾ ਏ ਤੁਸੀਂ ਮੈਨੂੰ ਦੱਸ ਸਕਦੇ ਹਾਂਜੀ ਹਾਂਜੀ ਮੈਂ ਉਰੇ ਪੰਜਾਬ ਵਿੱਚ ਘੁੰਮਣ ਬਾਰੇ ਵਿਚ ਆਈ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਤਲਬ ਬੱਸਾਂ ਵਿੱਚ ਸਹੂਲਤ ਨਹੀਂ ਹੈ ਫਿਰ ਉੱਧਰ ਰੇਲਵੇ ਏਅਰਪੋਰਟ ਵੱਲ ਕਿੱਦਾਂ ਹਾਂਜੀ ਹਾਂਜੀ ਓਕੇ ਅੱਛਾ ਓਕੇ ਹੋਰ

ਹਾਂਜੀ ਮਤਲਬ ਕਿ ਏਅਰਪੋਰਟ ਵਾਲਾ ਵੀ ਨਹੀਂ ਹੈ ਹਾਂਜੀ ਹਾਂਜੀ ਓਕੇ ਮਤ ਮਤਲਬ ਉਰੇ ਟ੍ਰੇਨ ਟਰੁਨ ਦਾ ਮੀਨਜ਼ ਕਿ ਕਿਰਾਇਆ ਕਿਸ ਤਰ੍ਹਾਂ ਏ ਠੀਕ ਹੈ ਕਿ ਜ਼ਿਆਦੇ ਹੈ ਨੋਰਮਲ ਵਿਅਕਤੀ ਕਰ ਸਕਦਾ ਹਮ ਹਾਂਜੀ ਠੀਕ ਹੈ ਹੋਰ ਮੀਨਸ ਕਿ ਸਿਸਟਮ ਵਧੀਆ ਮੀਨਜ਼ ਕਿ ਠੀਕ ਨਹੀਂ ਹੈ ਇਹਨਾਂ ਦਾ ਚਲੋ ਫਿਰ ਮੈਮ ਜਿਵੇਂ ਹੋਰ ਕੋਈ ਮੀਨਜ਼ ਕਿ ਜਾਣਕਾਰੀ ਲੈਣੀ ਹੋਵੇਗੀ ਮੈਂ ਤੁਹਾਨੂੰ ਪੁੱਛ ਲੂੰਗੀ